ਮੈਂ ਇੱਕ ਕਿਤਾਬ ਜ ਜਿਹੜੀ ਪਰਚੇਜ਼ ਕੀਤੀ ਆ ਜਿਹੜੀ ਸਤਿੰਦਰਪਾਲ ਸਿੰਘ ਨੇ ਐਡਿਟ ਕੀਤੀ ਹੈਗੀ ਹੈ ਜਿਹਦੇ 'ਚ ਸਾਰੇ ਪੰਜਾਬ ਦੇ ਗੁਰਦੁਆਰਿਆਂ ਦਾ ਅਤੇ ਉਹਨਾਂ ਦੀ ਹਿਸਟਰੀ ਨੂੰ ਰਿਕਾਰਡ ਕੀਤਾ ਗਿਆ ਬਹੁਤ ਸੋਹਣੀ ਬੁੱਕ ਹੈਗੀ ਹੈ ਬਹੁਤ ਵਧੀਆ ਪੇਜ਼ ਦੇ ਉੱਤੇ ਪ੍ਰਿੰਟ ਨੇ ਅਤੇ ਸਾਰੀ ਅਮੇਜ਼ ਜਿਹੜੀ ਇਮੇਜ਼ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈਗੀ ਆ ਅਤੇ ਪੂਰੀ ਜਾਣਕਾਰੀ ਉਸ ਕਿਤਾਬ ਦੇ ਵਿੱਚੋਂ ਜਿੰਨੇ ਇਤਿਹਾਸਿਕ ਗੁਰੂਦੁਆਰੇ ਨੇ ਸਾਰਿਆਂ ਦੀ ਉਪਲੱਬਧ ਹੈਗੀ ਹੈ ਮੈਨੂੰ ਲੱਗਦਾ ਉਹ ਹਰ ਸਾਰਿਆਂ ਨੂੰ ਖਰੀਦਣੀ ਚਾਹੀਦੀ ਹੈ ਅਤੇ ਹਦ ਘਰ ਦੀ ਲੋੜ ਜਿਹੜੀ ਹੈਗੀ ਹੈ ਬੱਚਿਆਂ ਨੂੰ ਸਿਖਾਉਣ ਦੇ ਲਈ